ਹੈਲੋ ਤੁਸੀਂ ਫਲਿਪਕਾਡ ਤੋਂ ਬੋਲ ਰਹੇ ਹੋ ਥੋੜ੍ਹੇ ਦਿਨ ਯੂਟਿਊਬ 'ਚ ਸਕਰੋਲ ਕਰਦੇ ਕਰਦੇ ਮੈਨੂੰ ਤੁਹਾਡੀ ਐਡ ਦਿਖੀ ਉਹਦੇ ਵਿੱਚ ਇਗਜ਼ਾਮ ਰਿਲੇਟਡ ਬੁੱਕਸ 'ਚ ਤੁਸੀਂ ਸੈਵਨਟੀ ਪ੍ਰਸੈਂਟ ਔਫ ਦੇ ਰਹੇ ਸੀ ਜਦੋਂ ਮੈਂ ਤੁਹਾਡੀ ਸਾਈਡ ਖੋਲ੍ਹੀ ਮੈਂ ਜੋ ਬੁੱਕ ਐਮ ਲਕਸ਼ਮੀ ਕਾਨ ਦੀ ਪੋਲੀਟੀ ਏਟਥ ਅਡੀਸ਼ਨ ਬਹੁਤ ਦਿਨਾਂ ਤੋਂ ਲੱਭ ਰਿਹਾ ਸੀ ਹਰ ਸਾਈਡ 'ਤੇ ਪਰ ਮੈਨੂੰ ਕਿਤੇ ਨਹੀਂ ਮਿਲੀ ਅਗਰ ਜੇ ਮੈਨੂੰ ਮਿਲਦੀ ਵੀ ਸੀ ਅਤੇ ਉਹ ਬਹੁਤ ਹੀ ਜ਼ਿਆਦਾ ਕੋਸਟਲੀ ਸੀ ਹਾਈ ਪ੍ਰਾਈਜ਼ ਸੀ ਪਰ ਜਦੋਂ ਮੈਂ ਤੁਹਾਡੀ ਸਾਈਡ 'ਤੇ ਚੈੱਕ ਕੀਤੀ ਬਹੁਤ ਹੀ ਰੀਜਨਏਬਲ ਪ੍ਰਾਈਜ਼ ਸੀ ਵਿਦ ਡਿਸਕਾਊਂਟ ਸੀ ਸੈਵਨਟੀ ਪ੍ਰਸੈਂਟ ਮੈਨੂੰ ਇੱਦਾਂ ਲੱਗਾ ਕਿ ਕੀ ਪਤਾ ਇਹ ਬੁੱਕ ਸਹੀ ਨਹੀਂ ਆਏਗੀ ਕਿਤੇ ਫਟੀ ਬੁੱਕਸ ਨਾ ਦੇ ਦੇਣ ਕਿਤੇ ਦੂਜਾ ਹੱਥ ਕਿਤਾਬ ਨਾ ਦੇ ਦੇਣ ਕਿਤੇ ਪੁਰਾਣਾ ਜੋੜ ਨਾ ਦੇ ਦੇਣ ਕਿਤੇ ਆਵੇ ਹੀ ਨਾ ਕੀ ਪਤਾ ਇਹ ਫੇਕ ਸਾਈਡ ਨਾ ਹੋਵੇ ਪਰ ਜਦੋਂ ਮੈਂ ਡਰਦੇ ਡਰਦੇ ਉਸਨੂੰ ਆਰਡਰ ਕੀਤਾ ਉਹਦੀ ਡਿਲੀਵਰੀ ਬਹੁਤ ਜਲਦੀ ਹੋ ਗਈ ਉਹਦੀ ਪੈਕਜਿੰਗ ਬਹੁਤ ਵਧੀਆ ਸੀ ਉਹ ਨਿਊ ਐਡੀਸ਼ਨ ਉਹ ਸੀਗਾ ਇਸ ਕਰਕੇ ਮੈਂ ਤੁਹਾਨੂੰ ਥੈਂਕ ਯੂ ਕਰਦਾ ਅਤੇ ਆਈ ਫਿਲ ਵੈਰੀ ਗੁੱਡ ਵਿਦ ਦਿਸ ਐਕਸਪੀਰੀਅੰਸ